ਇੱਕ ਕਿਤਾਬ ਦਾ ਨਾਂ ਹੈ ਪਾਰਸ ਤੋਂ ਪਾਰਸ ਇਹ ਕਿਤਾਬ ਬਿਆਸ ਸਤਸੰਗ ਘਰ 'ਚੋਂ ਖਰੀਦੀ ਸੀ ਅਤੇ ਪਹਿਲਾਂ ਤਾਂ ਮੈਨੂੰ ਇਹ ਕਿਤਾਬ ਬਿਲਕੁਲ ਵੀ ਨਹੀਂ ਲੱਗਿਆ ਕਿ ਮੈਨੂੰ ਸ਼ੁਰੂ ਵਿੱਚ ਨਹੀਂ ਪੜ੍ਹੀ ਵਧੀਆ ਨਹੀਂ ਲੱਗੀ ਅਤੇ ਬਾਅਦ ਜਿਵੇਂ ਜਿਵੇਂ ਮੈਂ ਪੜ੍ਹਨੀ ਸ਼ੁਰੂ ਕੀਤੀ ਅਤੇ ਮੇਰਾ ਇੰਟਰਸਟ ਵੱਧਦਾ ਗਿਆ ਅਤੇ ਮੈਂ ਹੁਣ ਇਹ ਕਿਤਾਬ ਨੂੰ ਪੜ੍ਹਦਾ ਹਾਂ ਅਤੇ ਮੇਰਾ ਮਨ ਬਦਲਿਆ ਅਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਵੀ ਹੋ ਗਈ ਹੈ ਅਤੇ ਅਤੇ ਕੁਛ ਪੰਨੇ ਐਸੇ ਹਨ ਜੋ ਜ਼ਿੰਦਗੀ ਨਾਲ ਬਹੁਤ ਚੰਗੀ ਤਰ੍ਹਾਂ ਆਧਾਰਿਤ ਹਨ ਅਤੇ ਕਿਸ ਤਰ੍ਹਾਂ ਕਿਸੇ ਗੁਰੂ ਦੇ ਲੜ ਲੱਗ ਕੇ ਇਨਸਾਨ ਮਾੜੇ ਤੋਂ ਚੰਗਾ ਹੁੰਦਾ ਅਤੇ ਪਾਰਸ ਤੋਂ ਪਾਰਸ ਬਣਦਾ ਹੈ ਅਤੇ ਮੈਨੂੰ ਬਹੁਤ ਪਸੰਦ ਆਈ ਅਤੇ ਹੁਣ ਮੈਂ ਇਸ ਨੂੰ ਮੇਰਾ ਮਨ ਬਦਲ ਗਿਆ ਇਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਪੜ੍ਹਦਾ ਹਾਂ ਅਤੇ ਉਸ ਦੀਆਂ ਵਿੱਚ ਲਿਖੀ ਗਈਆਂ ਗੱਲਾਂ ਨੂੰ ਆਪਣੇ ਮਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ ਹਾਂ